ਮੈਂ ਸਭ ਤੋਂ ਵੱਧ ਕਦਰ ਆਪਣੇ ਮਾਤਾ ਪਿਤਾ ਦੀ ਕਰਦਾ ਹਾਂ ਜਿਹਨਾਂ ਨੇ ਮੈਨੂੰ ਇਹ ਜਨਮ ਦਿੱਤਾ ਅਤੇ ਇੰਨੀ ਸੋਹਣੀ ਦੁਨੀਆ ਦਿਖਾਈ ਅਤੇ ਇੱਕ ਪੜ੍ਹਨ ਪੜ੍ਹਨ ਲਿਖਣੇ ਦਾ ਵੀ ਇੱਕ ਸਬੱਬ ਬਖਸ਼ਿਆ ਉਹਨਾਂ ਨੇ ਮਿਹਨਤ ਕਰਕੇ ਮੈਨੂੰ ਪੜ੍ਹਾਇਆ ਲਿਖਾਇਆ ਅਤੇ ਸਾਰੀ ਜ਼ਿੰਦਗੀ ਵਧੀਆ ਜ਼ਿੰਦਗੀ ਅਤੇ ਪੈਸੇ ਕਮਾਉਣ ਵਾਲੀ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ ਅਤੇ ਹੋਰ ਵੀ ਕਾਫ਼ੀ ਪ੍ਰਕਾਰ ਦੀਆਂ ਗੱਲਾਂ ਸਿਖਾਈਆਂ ਨੇ ਕਿਵੇਂ ਦੁਨੀਆ ਦੇ ਵਿੱਚ ਵਿਚਰਨਾ ਹੈ ਅਤੇ ਕਿਹੜੀਆਂ ਕਿਹੜੀਆਂ ਗਲਤ ਗੱਲਾਂ ਨੇ ਕਿਹੜੀਆਂ ਸਹੀ ਗੱਲਾਂ ਨੇ ਅਤੇ ਕਿਹੜੇ ਰਾਹ ਦੇ ਉੱਤੇ ਚੱਲਣਾ ਹੈ ਇਹ ਸਾਰੀਆਂ ਗੱਲਾਂ ਮਾਤਾ ਪਿਤਾ ਨੇ ਹੀ ਸਮਝਾਈਆਂ ਅਤੇ ਜ਼ਿੰਦਗੀ ਕਿਵੇਂ ਜਿਉਣੀ ਹੈ ਕਿਵੇਂ ਨਹੀਂ ਜਿਉਣੀ ਇਹ ਸਾਰਾ ਕੁਛ ਉਹਨਾਂ ਨੇ ਹੀ ਇੱਕ ਰੱਬ ਬਣ ਕੇ ਮੇਰੇ ਨਾਲ ਚੱਲ ਕੇ ਮੈਨੂੰ ਸਾਰਾ ਕੁਛ ਸਿਖਾਇਆ